ਹੈਲੋ ਹਾਂਜੀ ਸੀਮਾ ਮੈਮ ਹਾਂਜੀ ਮਨਜਿੰਦਰ ਬੋਲਦੀ ਹਾਂ ਗੁਡ ਮੋਰਨਿੰਗ ਹਾਂਜੀ ਗੁਡ ਮੋਰਨਿੰਗ ਮੈਮ ਹਾਂਜੀ ਗੁਡ ਮੋਰਨਿੰਗ ਹਾਜ ਹੋਰ ਸੁਣਾਓ ਕਿੱਦਾਂ ਮੈਮ ਠੀਕ ਠਾਕ ਹਾਂਜੀ ਬਸ ਠੀਕ ਠਾਕ ਵਧੀਆ ਹਾਂਜੀ ਮੈਮ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਕਿ ਮੈਂ ਐਜ ਅ ਟੂਰਿਸਟ ਆਉਣਾ ਸੀ ਜਲੰਧਰ ਘੁੰਮਣ ਹਾਂਜੀ ਮੈਨੂੰ ਕਿਸੇ ਨੇ ਨੰਬਰ ਦਿੱਤਾ ਸੀ ਤੁਹਾਡਾ ਕਿ ਬਹੁਤ ਵਧੀਆ ਗਾਈਡ ਤੁਸੀਂ ਕਰ ਸਕਦੇ ਹੋ ਸਾਨੂੰ ਜਿਹੜੇ ਰਹਿਣ ਵਾਲੇ ਆ ਹਾਂਜੀ ਹਾਂਜੀ ਠੀਕ ਹੈ ਹੋਰ ਤੁਸੀਂ ਕਿੱਥੇ ਰਹਿੰਦੇ ਮੈਮ ਅੱਛਾ ਅੱਛਾ ਹਾਂਜੀ ਮੈਂ ਮੈਮ ਇਧਰੋਂ ਦਿੱਲੀ ਵੱਲੋਂ ਆਉਣਾ ਸੀਗਾ ਹਾਂਜੀ ਹਾਂਜੀ ਦਿੱਲੀ ਤੋਂ ਆਉਣਾ ਸੀਗਾ ਮੈਂ ਵੈਸੇ ਥੋੜ੍ਹਾ ਪੰਜਾਬ ਛੁੱਟੀਆਂ ਸੀ ਬੱਚਿਆਂ ਨੂੰ ਅਤੇ ਥੋੜ੍ਹਾ ਪੰਜਾਬ 'ਚ ਹੀ ਦੇਖਣ ਬੱਚਿਆਂ ਨੂੰ ਘੁਮਾ ਲਈਏ ਐਕਚੁਲੀ ਅਸੀਂ ਰਹਿਣ ਵਾਲੇ ਤਾਂ ਪੰਜਾਬ ਦੇ ਆ ਅਤੇ ਫਿਰ ਸ਼ਿਫਟ ਹੋ ਗਏ ਸੀਗੇ ਸੀ ਉਧਰ ਤਾਂ ਹੁਣ ਛੁੱਟੀਆਂ ਸੀ ਬੱਚਿਆਂ ਨੂੰ ਅਤੇ ਅਸੀਂ ਕਿਹਾ ਵੀ ਚੱਲ ਬੱਚਿਆਂ ਨੂੰ ਘੁਮਾ ਲਿਆਈਏ ਪੰਜਾਬ 'ਚ ਹਾਂਜ ਹਾਂ ਹਾਂਜੀ ਅਸੀਂ ਮੈਂ ਬੱਚਿਆਂ ਨੂੰ ਛੁੱਟੀਆਂ ਸੀਗੀਆਂ ਹਾਂਜੀ ਵਿੰਟਰ ਵੀਕੇਸ਼ਨ ਦੀਆਂ ਸਰਦੀਆਂ ਦੀਆਂ ਹਾਂਜੀ ਅਤੇ ਉਦੋਂ ਅਸੀਂ ਆਉਣਾ ਤੁਸੀਂ ਦੱਸ ਸਕਦੇ ਹੋ ਥੋੜ੍ਹਾ ਜਿਹਾ ਜਲੰਧਰ ਦੇ ਬਾਰੇ ਮੈਂ ਕਾਫੀ ਕੁਝ ਸੁਣਿਆ ਉੱਦਾਂ ਜਲੰਧਰ ਬਾਰੇ ਜਿੱਦਾਂ ਇਹਦੇ ਵਿੱਚ ਪਾਰਕ ਅਤੇ ਗਾਰਡਨ ਕਾਫੀ ਅੱਛੇ ਆ ਫਿਰ ਹਾਂਜੀ ਨਹਿਰੂ ਗਾਰਡਨ ਵਗੈਰਾ

ਅੱਛਾ ਜੀ ਅੱਛਾ ਅੱਛਾ ਅੱਛਾ ਜੀ

ਅੱਛ ਹਾਂਜੀ ਮੈਮ ਬੱਚੇ ਤਾਂ ਹੈਗੇ ਵੱਡੇ ਆ ਇੱਕ ਏਟਥ ਵਿੱਚ ਆ ਬੱਚਾ ਅਤੇ ਇੱਕ ਪਲੱਸ ਵੰਨ 'ਚ ਆ ਹਾਂਜੀ ਫਿਰ ਵੀ ਅਸੀਂ ਕਿਹਾ ਚਲੋ ਬੱਚਿਆਂ ਨੂੰ ਥੋੜ੍ਹਾ ਹਾਂਜੀ ਵੰਡਰਲੈਂਡ ਅੱਛਾ ਅੱਛਾ ਜੀ ਅੱਛਾ ਅੱਛਾ ਠੀਕ ਹੈ ਹਾਂ ਹਾਂ

ਠੀਕ ਹਾਂਜੀ ਹਾਂਜੀ ਪਾਣੀ ਦੇ ਵਿੱਚ ਤਾਂ ਚਲੋ ਸਰਦੀਆਂ ਦੇ ਵਿੱਚ ਤਾਂ ਉਹਦਾ ਵੈਸੇ ਚਲੋ

ਹਾਂ ਅੱਛਾ ਅੱਛਾ ਹਾਂ ਠੀਕ ਹੈ ਅਸੀਂ ਕਿ ਚਲੋ ਫੈਮਲੀਜ ਹਾਂਜੀ ਅਸੀਂ ਆ ਰਹੇ ਆ ਮੈਂ ਫੰਕਸ਼ਨ ਸੀ ਉਹਨਾਂ ਨੇ ਫਰੈਂਡ ਹਾਂ ਹਾਂਜੀ ਬਰਡੇ ਪਾਰਟੀ ਸੀਗਾ ਫਿਰ ਅਸੀਂ ਕਿਹਾ ਚਲੋ ਸਾਰੇ ਫੈਮਲੀ ਜਾਂਦੇ ਹਾਂ ਅਤੇ ਬੱਚਿਆਂ ਨੂੰ ਨਾਲੇ ਘੁਮਾ ਲਿਆਵਾਂਗੇ ਕਾਫੀ ਦੇਰ ਹੋ ਗਏ ਸੀ ਹਾਂ ਜੀ ਹਾਂਜੀ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਆ ਹੋਰ ਮੈਮ ਇੱਥੇ ਰਹਿਣ ਰੁਹਣ ਦਾ ਕਿੱਦਾਂ ਹੈਗਾ ਇੱਥੇ

ਹਾਂਜੀ ਹਾਂਜੀ ਠੀਕ ਆ ਜੀ

ਹਾਂ ਹਾਂਜੀ ਹਾਂਜੀ ਫੇਰ ਛੁੱਟੀਆਂ ਸੀਗੀਆਂ ਬੱਚਿਆਂ ਨੂੰ ਅਸੀਂ ਕਿਹਾ ਚਲੋ ਬਾਅਦ ਵਿੱਚ ਥੋੜ੍ਹੇ ਬੱਚਿਆਂ ਨੂੰ ਘੁਮਾ ਲਾਂਗੇ ਚਲੋ ਠੀਕ ਹੈ ਮੈਮ ਹਾਂਜੀ ਹਾਂਜੀ ਚਲੋ ਹਾਂਜੀ ਹਾਂਜੀ ਠੀਕ ਹੈ ਮੈਮ ਓਕੇ ਧੰਨਵਾਦ ਤੁਹਾਡਾ ਬਹੁਤ ਬਹੁਤ ਜਦੋਂ ਆਵਾਂਗੇ ਤੁਹਾਨੂੰ ਫਿਰ ਜ਼ਰੂਰ ਕਾਲ ਹਾਂਜੀ ਠੀਕ ਹੈ ਜੀ ਓਕੇ